ਮੈਂ ਗੁਰਸੇਵਕ ਸਿੰਘ ਪੰਜਾ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵਿਖੇ ਸੇਵਾ ਨਿਭਾ ਰਿਹਾ ਹਾਂ ਇੱਥੇ ਕਈ ਵਾਰ ਨਾ ਬਹੁਤ ਸਾਰੀਆਂ ਪ੍ਰੋਬਲਮਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਇਸ ਜਗ੍ਹਾ 'ਤੇ ਜਿੱਥੇ ਸਾਡਾ ਦਫ਼ਤਰ ਬਣਿਆ ਕਾਫ਼ੀ ਸਾਰੇ ਦਫ਼ਤਰ ਬਣੇ ਹੋਏ ਨੇ ਕਈ ਵਾਰੀ ਕਿਸੇ ਨਾ ਕਿਸੇ ਦਫ਼ਤਰ ਦੇ ਅੱਗੇ ਕੋਈ ਧਰਨਾ ਕੋਈ ਰੈਲ਼ੀ ਕੋਈ ਰੋਸ ਮੁਜ਼ਹਾਰਾ ਤਕਰੀਬਨ ਚੱਲਦਾ ਹੀ ਰਹਿੰਦਾ ਇਹਦੇ ਨਾਲ਼ ਸਾਨੂੰ ਕਈ ਵਾਰੀ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਕਈ ਵਾਰ ਤਾਂ ਹਾਲਾਤ ਇਹੋ ਜਿਹੇ ਹੁੰਦੇ ਨੇ ਕਿ ਅਸੀਂ ਘਰ ਤੋਂ ਦਫ਼ਤਰ ਆ ਜਾਂਦੇ ਹਾਂ ਪਰ ਇੱਥੇ ਆ ਕੇ ਦਫ਼ਤਰ ਦੇ ਵਿੱਚ ਹੀ ਜਾਂ ਦਫ਼ਤਰ ਦੇ ਬਾਹਰ ਕੋਈ ਧਰਨਾ ਲੱਗ ਜਾਂਦਾ ਜਾਂ ਕਈ ਵਾਰੀ ਇਹ ਹੁੰਦਾ ਕਿ ਦਿਨ 'ਚ ਦਫ਼ਤਰ ਵਿੱਚ ਕੰਮ ਕਰ ਰਹੇ ਹਾਂ ਛੁੱਟੀ ਸਮੇਂ ਦੇਖਿਆ ਤਾਂ ਬਾਹਰ ਦਫ਼ਤਰ ਦੇ ਮੇਨ ਗੇਟ 'ਤੇ ਧਰਨਾ ਲੱਗਿਆ ਹੋਇਆ ਤਾਂ ਸਾਨੂੰ ਕਈ ਵਾਰੀ ਐਸੇ ਹਾਲਾਤ ਵੀ ਪੈਦਾ ਹੁੰਦੇ ਨੇ ਕਿ ਅਸੀਂ ਕੰਧਾਂ ਟੱਪ ਕੇ ਵੀ ਆਪਣੇ ਘਰ ਨੂੰ ਵਾਪਸ ਜਾਂਦੇ ਹਾਂ ਜਾਂ ਕਈ ਵਾਰੀ ਜ਼ਰੂਰੀ ਕੰਮ ਹੁੰਦਾ ਗੇਟ ਬੰਦ ਹੋਣ ਦੇ ਬਾਵਜੂਦ ਅਸੀਂ ਕੰਧ ਟੱਪ ਕੇ ਜਾਂ ਸਾਨੂੰ ਕਿਸੇ ਹੋਰ ਰਸਤੇ ਰਾਹੀਂ ਦਫ਼ਤਰ ਦੇ ਅੰਦਰ ਲ ਦਾਖ਼ਲ ਹੋਣਾ ਪੈਂਦਾ